ਯੋਗਾ ਕਰਨ ਦੇ ਨਾਲ ਆਪਣੇ ਸਰੀਰ ਨੂੰ ਸੰਭਾਲ ਰੱਖੀ ਜਾ ਸਕਦੀ ਹੈ ਇਹਦੇ ਨਾਲ ਸਾਡੇ ਸਰੀਰ ਨੂੰ ਚੁਸਤੀ ਵੀ ਆਉਂਦੀ ਹੈ ਅਤੇ ਤਾਕਤ ਵੀ ਮਿਲਦੀ ਹੈ ਯੋਗ ਸਾਨੂੰ ਬਹੁਤ ਬਿਮਾਰੀਆਂ ਲੱਗਣ ਤੋਂ ਬਚਾਉਂਦਾ ਹੈ ਤਨਾਅ ਨਹੀਂ ਹੁੰਦਾ ਕਦੇ ਵੀ ਸ ਕੋਈ ਟੈਂਸ਼ਨ ਨਹੀਂ ਹੁੰਦੀ ਕਿਸੇ ਕਿਸਮ ਦੀ ਸਵੇਰੇ ਉੱਠ ਕੇ ਇੱਕ ਵਾਰ ਯੋਗਾ ਕਰੋ ਔਰ ਉਸ ਤੋਂ ਬਾਅਦ ਤੁਹਾਡਾ ਸਰੀਰ ਤੰਦਰੁਸਤ ਰਹੇਗਾ